ਹੈਲੋ ਹਾਂਜੀ ਕੌਣ ਅੱਛਾ ਹਾਂ ਨੈਨਸੀ ਕਿਵੇਂ ਹੈਂ ਵਾ ਵਧੀਆ ਹੋਰ ਕੀ ਕਰਦੀ ਅੱਜ ਕੱਲ੍ਹ ਅੱਛਾ ਬਸ ਮੈਂ ਵੀ ਪਲੱਸ ਟੂ ਕੀਤੀ ਹੁਣੀ ਹੋਰ ਫਿਰ ਕੀ ਸੋਚਿਆ ਅੱਗੇ ਦਾ ਹਾਂ ਇੱਕ ਤਾਂ ਮੈਨੂੰ ਵੈਸੇ ਦੋ ਹੀ ਪਤਾ ਇੱਕ ਪੰਜਾਬ ਯੂਨੀਵਰਸਿਟੀ ਪਟਿਆਲਾ ਬਾਰੇ ਇੱਕ ਚੰਡੀਗੜ੍ਹ ਯੂਨੀਵਰਸਿਟੀ ਵੈਸੇ ਮੈਨੂੰ ਸੀ ਯੂ ਬਾਰੇ ਜ਼ਿਆਦਾ ਪਤਾ ਕਿਉਂਕਿ ਉੱਥੇ ਮੇਰੀ ਸਿਸਟਰ ਲੱਗੀ ਹੋਈ ਹੈ ਨਾ ਹਾਂ ਫਿਰ ਉੱਥੇ ਮੈਨੂੰ ਦੱਸਦੀ ਰਹਿੰਦੀ ਹੈ ਉੱਥੇ ਕਿਵੇਂ ਦਾ ਮਿਨੀਗ ਕਿ ਸਟਡੀ ਆ ਉੱਥੇ ਦੀ ਟੂਰ ਵਗੈਰਾ 'ਤੇ ਲੈ ਕੇ ਜਾਂਦੇ ਨੇ ਉਹ ਵੋ ਉੱਥੇ ਚਾਂਸ ਵੀ ਹੈ ਬੋਲਦੀ ਹੈ ਜੋਬ ਦੇ ਜਲਦੀ ਹੋ ਜਾਂਦੀ ਹੈ ਜੋਬ ਜਲਦੀ ਲੱਗ ਜਾਂਦੀ ਹੈ ਇੱਕ ਤਾਂ ਉਹ ਨੇੜੇ ਵੀ ਪੈ ਜਾਂਦੀ ਆਪਾਂ ਨੂੰ ਪੀ ਯੂ ਇੰਨੀ ਕੁ ਦੂਰ ਵੀ ਪੈਣੀ ਹੈ ਮੈਂ ਤਾਂ ਸੀ ਯੂ ਬਾਰੇ ਸੋਚ ਰਹੀ ਹਾਂ ਬਾਕੀ ਤੂੰ ਦੱਸ ਕਿੱਥੇ ਲੱਗਣਾ ਕੋਈ ਗੱਲ ਨਹੀਂ ਸੀ ਯੂ ਦੇਖ ਲੈ ਦੋ ਅ ਆਪਾਂ ਦੋਵਾਂ ਚੱਲੇ ਕਰਾਂਗੀਆਂ ਅਤੇ ਨੇੜੇ ਵੀ ਪੈ ਜਾਣੀ ਆ ਸਾਨੂੰ ਅਤੇ ਬਾਕੀ ਕਰਨਾ ਕੀ ਹੈ ਬੀ ਕੌਮ ਜਾਂ ਫਿਰ ਗ੍ਰੈਜੂਏਸ਼ਨ ਅੱਛਾ ਠੀਕ ਹੈ ਵਧੀਆ ਹੈ ਹੋਰ ਕੋਈ ਗੱਲ ਨਹੀਂ ਪੁੱਛ ਲੀਂ ਪੁੱਛ ਕੇ ਫਿਰ ਮੈਨੂੰ ਦੱਸ ਦੀਂ ਬਾਕੀ ਮੈਂ ਵੀ ਹਫਤੇ ਕੁ ਤੱਕ ਆਪਣੀ ਸਿਸਟਰ ਨਾਲ ਜਾ ਕੇ ਦੇਖੂੰਗੀ ਨਾ ਵੀ ਕਿਵੇਂ ਦੀ ਹੈ ਵੈਸੇ ਤਾਂ ਉਹ ਦੱਸਦੀ ਰਹਿੰਦੀ ਹੈ ਅਤੇ ਜਾ ਕੇ ਦੇਖ ਲਵਾਂਗੀ ਫਿਰ ਮੈਂ ਤੈਨੂੰ ਕੋਲ ਵੀ ਕਰਾਂਗੀ ਵੀ ਕਿਵੇਂ ਦੀ ਹੈ ਉਥੇ ਮੈਂ ਵੈਸੇ ਇਹ ਵੀ ਸੁਣਿਆ ਨਾ ਵੀ ਉੱਥੇ ਸਕੋਲਰਸ਼ਿਪ ਵੀ ਬਹੁਤ ਜਲਦੀ ਮਿਲ ਜਾਂਦੀ ਪੇਪਰ ਹੁੰਦਾ ਨਾ ਅਤੇ ਈਜ਼ੀ ਹੁੰਦਾ ਪੇਪਰ ਮੇਰੀ ਸਿਸਟਰ ਨੇ ਪਾਇਆ ਸੀ ਅਤੇ ਸਕੋਲਰਸ਼ਿਪ ਮਿਲ ਜਾਣੀ ਹੈ ਔਰ ਬਾਕੀ ਪਤਾ ਨਹੀਂ ਬਾਕੀ ਤੂੰ ਆਪਣਾ ਦੇਖ ਲੀਂ ਜਿੱਥੇ ਤੇਰੇ ਘਰ ਦੇ ਬੋਲੂਗੇ ਜੇ ਸੀ ਯੂ ਵਿੱਚ ਲੱਗਣਾ ਹੋਇਆ ਨਾ ਫਿਰ ਮੈਨੂੰ ਕੋਲ ਕਰਦੀ ਫਿਰ ਆਪਾਂ ਦੋਵਾਂ ਚੱਲਾਂਗੀਆਂ ਓਕੇ ਠੀਕ ਹੈ ਹਾਂ ਬਸ ਮੈਂ ਵੀ ਵੇਟ ਉਹਦੀ ਕਰਦੀ ਚੱਲ ਫਿਰ ਮੈਂ ਤੈਨੂੰ ਨਾ ਰੁਕ ਕੇ ਥੋੜ੍ਹੀ ਦੇਰ ਤੱਕ ਕੋਲ ਕਰਦੀ ਹਾਂ